ਮੇਰੇ ਪਿੰਡ ਦੇ ਭਾਈਚਾਰੇ ਵਿੱਚ ਕਈ ਲੋਕ ਕਾਮਯਾਬ ਕਾਰੋਬਾਰ ਕਰ ਰਹੇ ਹਨ ਜਿਨ੍ਹਾਂ ਵਿੱਚੋਂ ਇੱਕ ਕਰਿਆਨਾ ਸਟੋਰ ਹੈ ਕਿਉਂਕਿ ਮੇਰੇ ਪਿੰਡ ਦੇ ਲੋਕਾਂ ਨੂੰ ਰਾਸ਼ਨ ਲੈਣ ਲਈ ਸ਼ਹਿਰ ਜਾਣਾ ਪੈਂਦਾ ਸੀ ਜਿਸ ਨਾਲ ਉਹਨਾਂ ਨੂੰ ਬਹੁਤ ਹੀ ਔਖ ਹੁੰਦੀ ਸੀ ਪਿੰਡ ਵਿੱਚ ਕਰਿਆਨਾ ਸਟੋਰ ਖੁੱਲ੍ਹਣ ਨਾਲ ਉਹਨਾਂ ਦਾ ਇਹ ਕੰਮ ਸੌਖਾ ਹੋ ਗਿਆ ਹੈ ਇਸ ਤੋਂ ਇਲਾਵਾ ਮੈਡੀਕਲ ਸਟੋਰ ਕਿਉਂਕਿ ਪਿੰਡ ਵਿੱਚ ਕਈ ਵਾਰ ਕਿਸੇ ਵਿਅਕਤੀ ਦੀ ਬਿਮਾਰ ਹੋਣ ਕਰਕੇ ਮੈਡੀਕਲ ਸਟੋਰ ਬਹੁਤ ਦੂਰ ਹੁੰਦਾ ਸੀ ਜਿਸ ਕਾਰਨ ਉਹਨਾਂ ਨੂੰ ਇਸ ਲਈ ਵੀ ਬਹੁਤ ਹੀ ਔਖ ਦਾ ਸਾਹਮਣਾ ਕਰਨਾ ਪੈਂਦਾ ਸੀ ਮੈਡੀਕਲ ਸਟੋਰ ਪਿੰਡ ਵਿੱਚ ਖੁੱਲ੍ਹਣ ਨਾਲ ਲੋਕਾਂ ਲਈ ਇਹ ਵੀ ਸੌਖਾ ਹੋ ਗਿਆ ਹੈ ਕਿਉਂਕਿ ਕਿਸੇ ਵੀ ਐਮਰਜੰਸੀ ਵਿੱਚ ਉਹ ਪਿੰਡ ਦੇ ਮਹਿਕ ਮੈਡੀਕਲ ਸਟੋਰ ਤੋਂ ਦਵਾਈ ਲੈ ਸਕਦੇ ਹਨ ਅਤੇ ਆਪਣਾ ਚੈੱਕਅਪ ਕਰਵਾ ਸਕਦੇ ਹਨ ਇਸ ਤੋਂ ਇਲਾਵਾ ਔਰਗੈਨਿਕ ਖੇਤੀ ਜਿਸ ਵਿੱਚ ਲੋਕ ਅਨਾਜ ਫਲ ਸਬਜ਼ੀਆਂ ਆਦਿ ਉਗਾ ਸਕਦੇ ਹਨ ਅਤੇ ਫਿਰ ਉਹਨਾਂ ਨੂੰ ਮੰਡੀ ਵਿੱਚ ਵੇਚਦੇ ਹਨ ਇਹਨਾਂ ਦੀ ਸਫਲਤਾ ਦੇ ਮੁੱਖ ਕਾਰਨ ਹਨ ਨਵੀਂ ਤਕਨੀਕ ਦੀ ਵਰਤੋਂ ਸਿੱਧਾ ਗਾਹਕਾਂ ਤੱਕ ਪਹੁੰਚ ਸੂਚਿਤ ਅਤੇ ਗੁਣਵੱਤਾ ਪੰਜਾਬੀ ਅ ਸੱਭਿਆਚਾਰ ਨਾਲ ਜੁੜਿਆ ਪਿਆਰ ਧੰਨਵਾਦ